ਤਕਨੀਕੀ ਸੁਧਾਰ ਤੇ ਜੇਕਰ ਗੱਲ ਕੀਤੀ ਜਾਏ ਸਾਡੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਬਹੁਤ ਸਮੱਸਿਆ ਐ ਤਾਂ ਅੱਜ ਕੱਲ੍ਹ ਨਵੀਂ ਤਕਨੀਕ ਨਾਲ ਨਵੀਆਂ ਮਸ਼ੀਨਾਂ ਵਰਤ ਕੇ ਸਾਡੇ ਹੋ ਸੀਵਰੇਜਾਂ ਦੀ ਸਫ਼ਾਈ ਨੂੰ ਸੋਖਾ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਉਹ ਕਦੇ ਨਾ ਕਦੇ ਸਮੱਸਿਆ ਦਾ ਕਾਰਨ ਵੀ ਬਣ ਸਕਦਾ ਕਿਉਂਕੀ ਤਕਨੀਕ ਅੱਜ ਤੱਕ ਅੱਜ ਕੱਲ੍ਹ ਉਹ ਲੈਵਲ ਤੇ ਨਈਂ ਪਹੁੰਚ ਪਾਈ ਐ ਕੀ ਜਿੱਥੇ ਇਹ ਹੋ ਸਕੇ ਕੀ ਸ਼ਾਇਦ ਆਮ ਇਨਸਾਨ ਵੀ ਉਹ ਚੀਜ ਨੂੰ ਆਸਾਨੀ ਨਾਲ ਵਰਤ ਸਕੇ ਉਹ ਥੋੜੀ ਜਿਹੀ ਕਿਤੇ ਨਾ ਕਿਤੇ ਮੁਸ਼ਕਿਲਾਂ ਪੈਦਾ ਕਰ ਸਕਦਾ ਐ ਬਾਕੀ ਜੇ ਖੇਤੀਬਾੜੀ ਦੇ ਕਿੱਤੇ ਦੇ ਵਿੱਚ ਗੱਲ ਕਰੀਏ ਤਾਂ ਤਕਨੀਕ ਤਾਂ ਆ ਰਹੀ ਐ ਪਰ ਕਿਤੇ ਨਾ ਕਿਤੇ ਲੋਕਾਂ ਕੋਲੇ ਸ਼ਾਇਦ ਓਨਾ ਪੈਸਾ ਈ ਨਈਂ ਕਿ ਉਹ ਤਕਨੀਕ ਨੂੰ ਆਪਣੇ ਵਰਤੋਂ ਦੇ ਵਿੱਚ ਲੈ ਕੇ ਆ ਸਕਣ ਹੈਨਾ ਤੇ ਬਾਕੀ ਜੇ ਗੱਲ ਕਰੀਏ ਤਕਨੀਕ ਬਹੁਤ ਸੁਧਾਰ ਕਰ ਰਹੀ ਐ ਸਮੇਂ ਦੇ ਨਾਲ ਨਾਲ ਏ ਆਈ ਆ ਰਿਹਾ ਐ ਹੋਰ ਚੀਜਾਂ ਆ ਰਹੀਆਂ ਨੇ ਤੇ ਉਹਦੇ ਨਾਲ ਫਿਰ ਚੀਜਾਂ ਆਸਾਨ ਹੋ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਹ ਆਸਾਨੀ ਹੋਣ ਦੇ ਨਾਲ ਨਾਲ ਉਹ ਚੀਜਾਂ ਸਾਨੂੰ ਖਤਰੇ ਚ ਵੀ ਪਾ ਜਾਂਦੀਆਂ ਹਨ